ਤੁਸੀਂ ਮੇਰੇ ਦਿੱਤੇ ਹੋਏ ਸਥਾਨ 'ਤੇ ਪਹੁੰਚ ਗਏ ਹੋ ਪਰ ਮੈਨੂੰ ਤੁਸੀਂ ਕਿਤੇ ਨਜ਼ਰ ਨਹੀਂ ਆ ਰਹੇ ਤੁਹਾਡੀ ਟੈਕਸੀ ਦਾ ਰੰਗ ਕਿਹੜਾ ਮੈਂ ਤੁਹਾਨੂੰ ਬਹੁਤ ਦੇਰ ਤੋਂ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਨੂੰ ਤੁਸੀਂ ਕਿਤੇ ਨਹੀਂ ਨਜ਼ਰ ਆ ਰਹੇ ਨਾ ਹੀ ਤੇ ਤੁਹਾਡੀ ਗੱਡੀ ਨਜ਼ਰ ਆ ਰਹੀ ਹੈ ਤੁਸੀਂ ਬੱਤੀਆਂ ਵਾਲੇ ਚੌਂਕ 'ਤੇ ਹੀ ਹੋ ਨਾ ਦੇਖੋ ਮੈਂ ਰਵੀ ਕਰਿਆਨਾ ਸਟੋਰ ਦੇ ਬਿਲਕੁਲ ਨਾਲ ਹੀ ਖੜ੍ਹੀ ਹਾਂ ਮੇਰੇ ਸੱਜੇ ਪਾਸੇ ਚੌਂਕ 'ਤੇ ਪੀਜੇ ਵਾਲੀ ਇੱਕ ਰੇਹੜੀ ਵੀ ਲੱਗੀ ਹੋਈ ਹੈ ਅਤੇ ਖੱਬੇ ਪਾਸੇ ਲੈਂਸਕਾਟ ਵਾਲੀ ਦੁਕਾਨ ਹੈੈੈ ਕਿਰਪਾ ਕਰਕੇ ਤੁਸੀਂ ਮੈਨੂੰ ਵੇਖ ਕੇ ਹੀ ਲੱਭ ਲਉ ਮੈਂ ਤੁਹਾਨੂੰ ਨਜ਼ ਮੈਂ ਤੁਹਾਨੂੰ ਨਜ਼ਰ ਆ ਜਾਵਾਂ ਸ਼ਾਇਦ ਨੀ ਮੈਂ ਨੀਲੀ ਸ਼ਰਟ ਅਤੇ ਕਾਲੀ ਪੈਂਟ ਪਾਈ ਹੋਈ ਹੈ ਅਤੇ ਮੇਰੇ ਹੱਥ ਵਿੱਚ ਲੈਪਟੋਪ ਵਾਲਾ ਚਿੱਟਾ ਬੈਗ ਵੀ ਹੈ ਹਾਂ ਮੈਨੂੰ ਤੁਹਾਡੀ ਨ ਨ ਗੱਡੀ ਨਜ਼ਰ ਆਈ ਹਾਂ ਹਾਂ ਹਾਂ ਇੱਧਰ ਹੀ ਇੱਧਰ ਹੀ ਕਿਰਪਾ ਕਰਕੇ ਇੱਧਰ ਹੀ ਆ ਜਾਉ ਧੰਨਵਾਦ